ਮੇਰੀ ਮਨਪਸੰਦ ਗੇਮ ਫੁੱਟਬੋਲ ਹੈ ਜਿਸ ਨੂੰ ਕਿ ਮੈਂ ਆਪਣੇ ਬਚਪਨ ਤੋਂ ਹੀ ਖੇਡਦਾ ਆ ਰਿਹਾਂ ਕਿਉਂਕਿ ਗੇਮਾਂ ਖੇਡਣ ਦੇ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਜਿਸ ਕਰਕੇ ਮੈਂ ਫੁੱਟਬੋਲ ਖੇਡਣਾ ਸ਼ੁਰੂ ਕੀਤਾ ਇਹ ਮੇਰੀ ਮਨਪਸੰਦ ਗੇਮ ਹੈ ਅਤੇ ਮੈਂ ਸਵੇਰੇ ਅਤੇ ਸ਼ਾਮ ਮੈਦਾਨ ਵਿੱਚ ਜਾ ਕੇ ਫੁੱਟਬੋਲ ਆਪਣੇ ਦੋਸਤਾਂ ਦੇ ਨਾਲ ਖੇਡਦਾ ਹਾਂ ਅਤੇ ਸਾਡਾ ਕੋਚ ਸਾਨੂੰ ਫੁੱਟਬੋਲ ਬਹੁਤ ਹੀ ਵਧੀਆ ਸਿਖਾਉਂਦਾ ਹੈ ਅਤੇ ਉਹ ਸਾਡੇ ਉੱਤੇ ਬਹੁਤ ਮਿਹਨਤ ਕਰ ਰਿਹਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਫੁੱਟਬੋਲ ਪਲੇਅਰ ਬਣਨਾ ਚਾਹੁੰਦੇ ਹਾਂ ਅਤੇ ਆਪਣੇ ਦੇਸ਼ ਲਈ ਉਸਨੂੰ ਪ੍ਰਚਲਿਤ ਕਰਨਾ ਚਾਹੁੰਦੇ ਹਾਂ ਧੰਨਵਾਦ